ਅੱਜ ਕੱਲ੍ਹ ਵਿਗਿਆਨ ਦੀ ਜਾਣਕਾਰੀ ਹੋਣਾ ਸਾਰਿਆਂ ਨੂੰ ਹੀ ਜ਼ਰੂਰੀ ਹੈ ਅਤੇ ਮ ਵਿਗਿਆਨ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁ ਅਹਿਮ ਭੂਮਿਕਾ ਹੈਗੀ ਵਿਗਿਆਨ ਨੇ ਸਾਡੇ ਸਾਡੇ ਲਈ ਬਹੁਤ ਸਾਰੀਆਂ ਕਾਢਾਂ ਕੱਢੀਆਂ ਜਿਵੇਂ ਮੁਬਾਈਲ ਫੋਨ ਟੈਬਲਿਟ ਕੰਪਿਊਟਰ ਆਦਿ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਦੀ ਗਲਤ ਵਰਤੋਂ ਕਰਦੇ ਨੇਗੇ ਅਤੇ ਦੂਜਿਆਂ ਨੂੰ ਪ੍ਰੇਸ਼ਾਨ ਕਰਦੇ ਨੇਗੇ ਇਹ ਕੰ ਵਿਗਿਆਨ ਰਾਹੀਂ ਜਿਵੇਂ ਬਿਜਲੀ ਪਾਉਣਾ ਅਤੇ ਪਾਣੀ ਕਿਵੇਂ ਬਣਨਾ ਇਹ ਸਾਰੀਆਂ ਕਾਢਾਂ ਵਿਗਿਆਨ ਰਾਹੀਂ ਕੱਢੀਆਂ ਗਈਆਂ ਨੇਗੀਆਂ ਅਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਵਿਗਿਆਨ ਦੀ ਜਾਣਕਾਰੀ ਹੀ ਨਹੀਂ ਹੈਗੀ ਗੀ ਵਿਗਿਆਨ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਅਹਿਮ ਭੂਮਿਕਾ ਨਿਭਾਈ ਐਗੀ ਇਹਦੇ ਨਾਲ ਸਾਡੀ ਦੇਸ਼ ਦੀ ਬਹੁਤ ਤਰੱਕੀ ਹੋਈ ਐਗੀ ਅਤੇ ਇਹਦੇ ਨਾਲ ਸਾਡਾ ਦੇਸ਼ ਦਾ ਬਹੁਤ ਸਾਰਾ ਸੁਧਾਰ ਹੋਇਆ ਗਾ ਅਤੇ ਲੋਕਾਂ ਨੂੰ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਮਿਲੀਆਂ ਨੇ ਅਤੇ ਜ਼ਿੰਦਗੀ ਜਿਓਣ ਦਾ ਇੱਕ ਤਜ਼ਰਬਾ ਆਇਆ ਗਾ ਲੋਕਾਂ ਨੂੰ ਧੰਨਵਾਦ